ਉਂਝ ਤਾਂ ਪੂਰੇ ਭਾਰਤ ਵਿੱਚ ਬਹੁਤ ਜ਼ਿਆਦਾ ਆਬਾਦੀ ਹੈ ਪਰ ਪੰਜਾਬ ਵੀ ਕਦੇ ਕਿਸੇ ਤੋਂ ਘੱਟ ਨਹੀਂ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਆਬਾਦੀ ਹੈ ਪੰਜਾਬ ਵਿੱਚ ਰਹਿਣ ਵਾਲੇ ਹਰ ਪ੍ਰਕਾਰ ਦੇ ਜਾਤ ਪਾਤ ਦੇ ਬੰਦੇ ਅਤੇ ਹਰ ਥਾਵਾਂ ਤੋਂ ਆਏ ਹੋਏ ਪਰਦੇਸੀਆਂ ਰਹਿੰਦੇ ਹਨ ਪੰਜਾਬ ਵਿੱਚ ਤਿਉਹਾਰ ਮਨਾਉਣ ਲਈ ਹਮੇਸ਼ਾ ਭਾਈਚਾਰਾ ਅਤੇ ਖੁਸ਼ੀਆਂ ਅਤੇ ਰੁਚੀਆਂ ਦਿਖਾਈ ਗਈਆਂ ਹਨ ਪੰਜਾਬ ਇੱਕ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀਆਂ ਦੀ ਜਗ੍ਹਾ ਹੈ ਪੰਜਾਬ ਵਿੱਚ ਰਹਿਣ ਵਾਲੀ ਆਬਾਦੀ ਹਮੇਸ਼ਾ ਹੀ ਖੁਸ਼ ਰਹੀ ਹੈ ਜਿਸ ਵਿੱਚ ਪੰਜਾਬ ਦੇ ਹਰ ਇੱਕ ਇਨਸਾਨ ਨੂੰ ਪਿਆਰ ਅਤੇ ਖੁਸ਼ੀਆਂ ਨਾਲ ਰੱਖਿਆ ਜਾਂਦਾ ਹੈ ਪੰਜਾਬ ਵਿੱਚ ਮਨਾਉਣ ਜਾਣ ਵਾਲੇ ਹਰ ਇੱਕ ਤਿਉਹਾਰ ਨੂੰ ਹਰ ਇੱਕ ਇਨਸਾਨ ਨਾਲ ਪਿਆ ਬੜੇ ਹੀ ਪਿਆਰ ਅਤੇ ਰੁਚੀ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ ਪੰਜਾਬ ਦੀ ਸੰਸਕ੍ਰਿਤੀ ਬਹੁਤ ਜ਼ਿਆਦਾ ਚੰਗੀ ਹੈ ਅਤੇ ਪੰਜਾਬ ਵਿੱਚ ਕਦੇ ਵੀ ਕਿਸੇ ਵੀ ਜਾਤ ਪਾਤ ਨੂੰ ਲੈ ਕੇ ਰੌਲਾ ਨਹੀਂ ਪਾਇਆ ਜਾਂਦਾ ਅਤੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਆਖਿਆ ਜਾਂਦਾ ਪੰਜਾਬ ਇੱਕ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਚੰਗਾ ਸਟੇਟ ਹੈ ਪੰਜਾਬ ਵਿੱਚ ਕਦੇ ਵੀ ਜਾਤ ਪਾਤ ਨੂੰ ਨੀਵਾਂ ਜਾਂ ਉੱਚਾ ਨਹੀਂ ਦਿਖਾਇਆ ਜਾਂਦਾ ਪੰਜਾਬ ਵਿੱਚ ਸਭ ਨੂੰ ਹਰੇਕ ਨੂੰ ਇੱਕ ਨਜ਼ਰ ਵਿੱਚ ਦੇਖਿਆ ਜਾਂਦਾ ਹੈ ਅਤੇ ਬੜੇ ਪਿਆਰ ਨਾਲ ਅਤੇ ਸਤਿਕਾਰ ਨਾਲ ਰੱਖਿਆ ਜਾਂਦਾ ਹੈ ਪੰਜਾਬ ਵਿੱਚ ਹਰੇਕ ਜਾਤ ਨੂੰ ਹਰੇਕ ਕੰਮ ਨੂੰ ਮਾਨਵਤਾ ਦਿੱਤੀ ਜਾਂਦੀ ਹੈ ਪਿਆਰ ਦਿੱਤਾ ਜਾਂਦਾ ਹੈ ਖੁਸ਼ੀਆਂ ਦਿੱਤੀ ਜਾਂਦੀਆਂ ਅਤੇ ਬਹੁਤ ਹੀ ਜ਼ਿਆਦਾ ਇੱਜਤ ਦਿੱਤੀ ਜਾਂਦੀ ਹੈ ਪੰਜਾਬ ਇੱਕ ਸੋਨੇ ਦੀ ਚਿੜੀਆ ਹੈ